ਮੇਰੇ ਪਿੰਡ ਵਿੱਚ ਮੇਰੇ ਘਰ ਦੇ ਨੇੜੇ ਤਿੰਨ ਕਰਿਆਨਾ ਸਟੋਰ ਹਨ ਬਬੀਹਾ ਕਰਿਆਨਾ ਸਟੋਰ ਰਥੋਰ ਵਰਾਟੀ ਕਰਿਆਨਾ ਸਟੋਰ ਨੂਰ ਕਰਿਆਨਾ ਸਟੋਰ ਇੱਥੇ ਕਈ ਤਰ੍ਹਾਂ ਦੀਆਂ ਚੀਜ਼ਾਂ ਉਪਲਬਧ ਹਨ ਜਿਵੇਂ ਕਿ ਔਰਤਾਂ ਦਾ ਸਮਾਨ ਔਰਤਾਂ ਦੇ ਸਮਾਨ ਵਿੱਚ ਲਪਿਸਟਿਕ ਬਿੰਦੀ ਨੇਲਪੋਲਿਸ਼ ਹੇਅਰ ਅਸੇਸਰੀ ਆਦਿ ਸਮਾਨ ਉਪਲਬਧ ਹੈ ਅਤੇ ਇੱਥੇ ਰਾਸ਼ਨ ਦਾ ਸਮਾਨ ਵੀ ਮਿਲਦਾ ਹੈ ਰਾਸ਼ਨ ਦੇ ਸਮਾਨ ਵਿੱਚ ਜਿਵੇਂ ਕਿ ਦਾਲ ਆਟਾ ਤੇਲ ਚਿੱਟੇ ਛੋਲੇ ਕਾਲੇ ਛੋਲੇ ਲੂਣ ਮਿਰਚ ਹਲਦੀ ਆਦਿ ਸਮਾਨ ਮਿਲਦਾ ਹੈ ਇੱਥੇ

ਕਿਸੇ ਵੀ ਕਰਿਆਨਾ ਸਟੋਰ ਤੋਂ ਜੇਕਰ ਸਮਾਨ ਲੈਂਦੀ ਹਾਂ ਤਾਂ